ਅੱਜ ਕੱਲ੍ਹ ਦੇ ਸਮੇਂ ਵਿੱਚ ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਜਿਹੜੀ ਹੈ ਉਹ ਹਰ ਇੱਕ ਵਿਦਿਆਰਥੀ ਦੀ ਲੋੜ ਬਣ ਚੁੱਕੀ ਹੈ ਕਿ ਉਹਨਾਂ ਨੂੰ ਸਬਜੈਕਟ ਹੀ ਇੰਨੇ ਜ਼ਿਆਦਾ ਹੈਗੇ ਨੇ ਕਿ ਸਕੂਲ ਦੇ ਵਿੱਚ ਵੀ ਪ੍ਰੋਪਰ ਉਸ ਚੀਜ਼ ਦੀ ਜਿਹੜੀ ਹੈਗੀ ਹੈ ਰਿਵੀਜ਼ਨ ਜਾਂ ਅਭਿਆਸ ਜਿਹੜਾ ਉਸਦਾ ਸੰਪੂਰਨ ਤੌਰ ਨਾਲ ਨਹੀਂ ਹੋ ਪਾਉਂਦਾ ਫਿਰ ਅੱਜ ਕੱਲ੍ਹ ਦੀ ਜਿਹੜੀ ਪੜ੍ਹਾਈ ਹੈ ਉਹ ਇੰਨੀ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ ਕਿ ਮਾਪੇ ਜਿਹੜੇ ਨੇ ਉਹ ਉਹਨਾਂ ਨੂੰ ਘਰ ਦੇ ਵਿੱਚ ਹੀ ਬੱਚਿਆਂ ਨੂੰ ਕਹਿ ਲਓ ਪੜ੍ਹਾਉਣਾ ਮੁਸ਼ਕਿਲ ਹੋ ਜਾਂਦਾ ਹੈ ਫਿਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਇੱਕੀਵੀਂ ਸਦੀ ਦੇ ਵਿੱਚ ਆਪਾਂ ਸਾਰੇ ਰਹਿ ਰਹੇ ਹਾਂ ਮਾਪੇ ਜਿਹੜੇ ਨੇ ਉਹ ਪਿਤਾ ਤਾਂ ਬੱਚਿਆਂ ਦੇ ਕੰਮ 'ਤੇ ਜਾਂਦੇ ਨੇ ਨਾਲ ਦੇ ਨਾਲ ਉਹਨਾਂ ਦੇ ਜਿਹੜੇ ਮਦਰ ਹੈ ਉਹ ਵੀ ਕਿਸੇ ਨਾ ਕਿਸੇ ਪੱਖੋਂ ਕੰਮ ਜਿਹੜਾ ਹੈ ਉਹਨਾਂ ਨੇ ਕੋਈ ਨਾ ਕੋਈ ਸ਼ੁਰੂ ਕੀਤਾ ਹੁੰਦਾ ਭਾਵੇਂ ਤੁਸੀਂ ਘਰ ਦੇ ਵਿੱਚ ਬੁਟੀਕ ਲੈ ਲਓ ਚਾਹੇ ਕੋਈ ਕਹਿ ਲਓ ਕਿਸੇ ਦੇ ਮਦਰ ਜਿਹੜੇ ਹੈਗੇ ਨੇ ਉਹ ਔਫਿਸ ਦੇ ਵਿੱਚ ਜਾਂਦੇ ਨੇ ਸੋ ਮਾਪਿਆਂ ਦੇ ਕੋਲ ਵੀ ਕਹਿ ਲਓ ਇੰਨਾ ਸਮਾਂ ਨਹੀਂ ਹੁੰਦਾ ਕਿ ਆਪਦੇ ਬੱਚਿਆਂ ਦਾ ਹੋਮਵਰਕ ਕਰਵਾ ਸਕਣ ਉਹਨਾਂ ਨੂੰ ਬਕਾਇਦਾ ਹਰ ਚੀਜ਼ ਦੀ ਰਵੀਜ਼ਨ ਕਰਵਾ ਸਕਣ ਜਿਸ ਕਰਕੇ ਟਿਊਸ਼ਨ ਜਿਹੜੀ ਹੈ ਉਹ ਹਰ ਬੱਚੇ ਦੀ ਇੱਕ ਲੋੜ ਬਣ ਚੁੱਕੀ ਹੈ ਦੂਜਾ ਟਿਊਸ਼ਨ ਜਿਹੜਾ ਹੈ ਉਹ ਜਿਹੜੇ ਹੈਗੀਆਂ ਨੇ ਪੜ੍ਹੇ ਲਿਖੀਆਂ ਬੱਚੇ ਜਿਹੜੇ ਹੈਗੇ ਨੇ ਜਿਵੇਂ ਉਹਨਾਂ ਨੂੰ ਇੱਕ ਆਮਦਨ ਦਾ ਸਾਧਨ ਵੀ ਦੇ ਦਿੰਦਾ ਹੈ ਕਿ ਜਿਵੇਂ ਉਹ ਆਪਣੇ ਤੋਂ ਛੋਟੀਆਂ ਕਲਾਸਾਂ ਨੂੰ ਬੜੇ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਨੇ ਕਈ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਕੇ ਹਟੇ ਹੁੰਦੇ ਨੇ ਤਾਂ ਉਹ ਆਪਣੇ ਤੋਂ ਛੋਟੀਆਂ ਕਲਾਸਿਸ ਜਿਹੜੀਆਂ ਨੇ ਉਹਨਾਂ ਨੂੰ ਟਿਊਸ਼ਨ ਦੇ ਕੇ ਫਿਰ ਨਾਲ ਦੀ ਨਾਲ ਉਹਨਾਂ ਦੀ ਰਵੀਜ਼ਨ ਵਗੈਰਾ ਜਿਹੜੀ ਹੈ ਉਹਦੇ ਵਿੱਚ ਮਤਲਬ ਕਹਿ ਲਓ ਉਹਨਾਂ ਦੀ ਪੜ੍ਹਾਈ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਨੇ ਪੇਂਡੂ ਇਲਾਕਿਆਂ ਦੇ ਵਿੱਚ ਟਿਊਸ਼ਨ ਜਿਹੜੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਬੱਚੇ ਸਕੂਲਾਂ ਦੇ ਨਾਲ ਨਾਲ ਆਪਣੇ ਇਸ ਤਰ੍ਹਾਂ ਟਿਊਸ਼ਨ ਟੀਚਰਾਂ ਦੇ ਕੋਲੋਂ ਵੀ ਬੜੇ ਵਧੀਆ ਢੰਗ ਦੇ ਨਾਲ ਪੜ੍ਹ ਲੈਂਦੇ ਨੇ